ਹੈਲੋ ਸਤਿ ਸ਼੍ਰੀ ਅਕਾਲ ਭੈਣੇ ਹੋਰ ਦੱਸੋ ਅਸੀਂ ਭੈਣੇ ਪਿਛਲੇ ਇੱਕ ਸਾਲ ਵਿੱਚ ਡੇਢ ਸੌ ਤੋਂ ਜ਼ਿਆਦਾ ਸ਼ਾਦੀਆਂ ਕਰ ਚੁੱਕੇ ਹਨ ਅਤੇ ਸਾਡਾ ਪੈਕੇਜ ਇੰਗੇਜਮੈਂਟ ਦਾ ਪੈਕੇਜ ਆ ਪੱਚੀ ਹਜ਼ਾਰ ਰੁਪਏ ਦਾ ਅਤੇ ਵਿਆਹ ਦਾ ਪੈਕਜ ਪੰਜਾਹ ਹਜ਼ਾਰ ਰੁਪਏ ਦਾ ਹੈ ਜਿਹਦੇ ਵਿੱਚ ਹਲਦੀ ਮਹਿੰਦੀ ਦੀ ਰਸਮ ਵੀ ਨਾਲ ਹੀ ਕੀਤੀ ਜਾਂਦੀਆਂ ਨੇ ਨਹੀਂ ਭੈਣੇ ਇਹ ਸਾਰਾ ਪੈਕੇਜ ਪੰਜਾਹ ਹਜ਼ਾਰ ਦੇ ਵਿੱਚ ਹੋ ਜਾਂਦਾ ਜੀ ਭੈਣ ਤੁਹਾਨੂੰ ਕੋਈ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਜਾਵੇਗਾ ਅਤੇ ਤੁਹਾਡਾ ਸਾਰਾ ਕੰਮ ਵਧੀਆ ਤੋਂ ਵਧੀਆ ਕੀਤਾ ਜਾਵੇਗਾ ਅਤੇ ਭੈਣੇ ਇਹਦਾ ਪੈਕੇਜ ਦਾ ਰੇਟ ਪੱਚੀ ਹਜ਼ਾਰ ਰੁਪਇਆ ਬਾਕੀ ਕੋਈ ਨਹੀਂ ਤੁਹਾਡਾ ਮਾਨ ਵੀ ਕੀਤਾ ਜਾਵੇਗਾ ਜਦੋਂ ਤੁਸੀਂ ਬੁੱਕ ਕਰੋਗੇ ਨਹੀਂ ਭੈਣੇ ਤੁਹਾਨੂੰ ਕੋਈ ਵੀ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਜਾਵੇ ਤੁਹਾਡਾ ਸਾਰਾ ਕੰਮ ਬਹੁਤ ਹੀ ਵਧੀਆ ਤਰੀਕੇ ਨਾਲ ਕੀਤਾ ਜਾਵੇਗਾ ਜੀ ਭੈਣੇ ਤੁਸੀਂ ਵੇਖ ਸਕਦੇ ਹੋ ਸਾਡੀ ਐਲਬਮ ਨੇ ਦੁਕਾਨ ਵਿੱਚ ਅਤੇ ਜਿਹੜੀਆਂ ਵੀ ਸਾਡੀ ਦੁਕਾਨ ਦੇ ਵਿੱਚ ਤਸਵੀਰਾਂ ਲੱਗੀਆਂ ਨੇ ਸਾਡੀ ਸਾਰੀ ਹੀ ਖੁਦ ਦੀ ਪਲੈਨਿੰਗਾਂ ਦੇ ਫੋਟੋਆਂ ਨੇ ਇਹ ਭੈਣੇ ਅਸੀਂ ਕੈਮਰੇ ਸੋਨੀ ਦੇ ਸਾਰੇ ਅਪਡੇਟਿਡ ਲੈਂਸ ਨੇ ਹਾਂਜੀ ਭੈਣੇ ਸਾਡੀ ਇਨਵੈਸਟਮੈਂਟ ਸਾਡੀ ਇਨਵੈਸਟਮੈਂਟ ਬਹੁਤ ਵਧੀਆ ਕੀਤੀ ਹੈ ਤਾਂ ਹੀ ਸਾਡੇ ਫੰਕਸ਼ਨਾਂ ਵਿੱਚ ਬਹੁਤ ਹੀ ਸਾਰੇ ਵਧੀਆ ਵਧੀਆ ਫੋਟੋਆਂ ਆਉਂਦੀਆਂ ਨੇ ਅਤੇ ਤਾਂ ਹੀ ਲੋਕ ਸਾਡੇ ਵੈ ਵੈਡਿੰਗ ਪਲੈਨਰਾਂ ਬਾਰੇ ਹੋਰਾਂ ਨੂੰ ਵੀ ਦੱਸਦੇ ਨੇ ਜੀ ਜੀ ਭੈਣੇ ਅਸੀਂ ਸ਼ੂਟ ਕੀਤਾ ਸੀ ਉਹ ਵੀ ਅਤੇ ਉਸ ਤੋਂ ਬਾਅਦ ਤਿੰਨ ਚਾਰ ਹੋਰ ਗਾਣੇ ਵੀ ਸ਼ੂਟ ਕੀਤੇ ਹਨ ਜੀ ਭੈਣ ਤੁਸੀਂ ਸਹੀ ਜੀ ਭੈਣੇ ਸਾਡੇ ਕੋਲ ਸਾਰੀਆਂ ਲਾਈਟਾਂ ਨੇ ਫਲੈਸ਼ਿਜ਼ ਵਾਲੀਆਂ ਅਤੇ ਸਾਡੀ ਸਾਰੀਆਂ ਫੋਟੋਆਂ ਬਹੁਤ ਹੀ ਵਧੀਆ ਅਤੇ ਸਾਫ ਆਉਣਗੀਆਂ ਜਿਵੇਂ ਪੂਰੇ ਦਿਨ ਵਿੱਚ ਖਿੱਚੀਆਂ ਹੋਣ ਸਾਡੀ ਸਾਰੀ ਵੀਡੀਓ ਅਤੇ ਕੈਮਰਾ ਅਪਡੇਟਿਡ ਲੈਂਸ ਜਿਵੇਂ ਤੁਹਾਨੂੰ ਮੈਂ ਦੱਸਿਆ ਸਾਡੇ ਕੋਈ ਵੀ ਫੰਕਸ਼ਨ ਦੇ ਵਿੱਚ ਸਾਰ ਵਧੀਆ ਤਰੀਕੇ ਨਾਲ ਰਿਕਾਰਡ ਕੀਤਾ ਜਾਵੇਗਾ ਇਹ ਨਾ ਵੀ ਸਾਡੀ ਟੀਮ ਹੁੰਦੀ ਹੈਗੀ ਹੈ ਛੋਟੇ ਫੰਕਸ਼ਨਾਂ ਵਾਸਤੇ ਚਾਰ ਹੈਲਪਰ ਅਤੇ ਦੋ ਮੇਨ ਫੋਟੋਗ੍ਰਾਫਰ ਹੁੰਦੇ ਨੇ ਅਤੇ ਵੱਡੇ ਵੱਡੇ ਵੱਡੇ ਫੰਕਸ਼ਨ ਵਾਸਤੇ ਛੇ ਅਤੇ ਕੈਮਰਾ ਛੇ ਕੈਮਰਾਮੈਨ ਅਤੇ ਦੋ ਵੱਡੇ ਫੋਟੋਗ੍ਰਾਫਰ ਹੁੰਦੇ ਨੇ ਜੀ ਭੈਣੇ ਹਾਂਜੀ ਭੈਣੇ ਉਹ ਤਾਂ ਸਾਡਾ ਜਿਵੇਂ ਜੇ ਕਿਸੇ ਨੇ ਸੌਂਗ ਸ਼ੂਟ ਕਰਾਉਣਾ ਹੋਵੇ ਤਾਂ ਉਹ ਤੀਹ ਹਜਾਰ ਦੇ ਵਿੱਚ ਸ਼ੂਟ ਹੋ ਜਾਂਦਾ ਪੂਰਾ ਸੋਂਗ 'ਤੇ ਜੇ ਕਿਸੇ ਨੇ ਖਾਲੀ ਫੋਟੋਆਂ ਕਰਾਣੀਆਂ ਹੋਣ ਤਾਂ ਉਹ ਦਸ ਹਜ਼ਾਰ ਰੁਪਏ 'ਚ ਹੋ ਜਾਂਦੀਆਂ ਨੇ ਭੈਣੇ ਕੋਈ ਗੱਲ ਨਹੀਂ ਜਦੋਂ ਤੁਸੀਂ ਕਰੋਗੇ ਬੁੱਕ ਤਾਂ ਤੁਹਾਡਾ ਮਾਨ ਕੀਤਾ ਜਾਵੇਗਾ ਪੂਰਾ ਕੋਈ ਗੱਲ ਨਹੀਂ ਭੈਣੇ ਤੁਸੀਂ ਤੁਹਾਨੂੰ ਦੱਸ ਦਾਂਗੇ ਤੁਹਾਨੂੰ ਜਦੋਂ ਆਓਗੇ ਉਦੋਂ ਪੂਰਾ ਮਾਨ ਤਾਨ ਕਰ ਦਿਆਂਗੇ ਜੀ ਭੈਣੇ ਕੋਈ ਗੱਲ ਨਹੀਂ ਭੈਣੇ ਕੋਈ ਗੱਲ ਨਹੀਂ ਤੁਹਾਨੂੰ ਕਰ ਦਾਂਗੇ ਵੀਹ ਹਜ਼ਾਰ 'ਚ ਕਰ ਦਾਂਗੇ ਭੈਣੇ ਠੀਕ ਹੈ ਭੈਣੇ ਠੀਕ ਹੈ ਭੈਣ ਧੰਨਵਾਦ